ਜਿਵੇਂ ਕਿ ਅਸੀਂ ਵੇਖਦੇ ਹਾਂ ਕਿ ਚੂਹੇ ਅਤੇ ਕੋਕਰੋਚ ਸਾਡੇ ਘਰਾਂ ਵਿੱਚ ਆਮ ਹੀ ਹੁੰਦੇ ਹਨ ਇਹ ਸਭ ਸਾਡੇ ਘਰ ਵਿੱਚ ਕਿਉਂ ਆਉਂਦੇ ਹਨ ਅਤੇ ਕਿਉਂ ਇਹ ਇਸ ਕਰਕੇ ਹੁੰਦੇ ਹਨ ਕਿਉਂਕਿ ਉਸ ਥਾਂ 'ਤੇ ਗੰਦਗੀ ਹੁੰਦੀ ਹਨ ਚੂਹੇ ਅਤੇ ਕੋਕਰੇਚ ਜਿਸ ਜਗ੍ਹਾ 'ਤੇ ਗੰਦਗੀ ਜਾਂ ਨਾਲੀਆਂ ਭਰੀਆਂ ਹੁੰਦੀਆਂ ਹਨ ਉਸ ਥਾਵਾਂ 'ਤੇ ਆਉਂਦੇ ਹਨ ਇਸ ਕਰਕੇ ਸਾਨੂੰ ਸਾਡੇ ਘਰ ਨੂੰ ਸਾਫ ਸੁਥਰਾ ਰੱਖਣਾ ਚਾਹੀਦਾ ਹੈ ਅਤੇ ਇਹਨਾਂ ਜਿਹਨਾਂ ਨਾਲੀਆਂ ਰਾਹੀਂ ਕੋਕਰੋਚ ਘਰ ਦੇ ਅੰਦਰ ਦਾਖਲ ਹੁੰਦੇ ਹਨ ਉਹਨਾਂ ਨੂੰ ਬੰਦ ਕਰਕੇ ਰੱਖਣਾ ਚਾਹੀਦਾ ਹੈ ਇੱਕ ਵਾਰ ਕੀ ਹੋਇਆ ਕਿ ਮੈਂ ਕਿਸੇ ਹੋਟਲ ਵਿੱਚ ਖਾਣਾ ਖਾ ਰਿਹਾ ਸੀ ਅਤੇ ਮੇਰੇ ਖਾਣੇ ਦੀ ਪਲੇਟ ਵਿੱਚ ਇੱਕ ਕਾਕਰੋਜ ਨਿਕਲ ਆਇਆ ਅਤੇ ਮੈਂ ਉਸ ਵਕਤ ਹੀ ਹੋਟਲ ਦੇ ਮੈਨੇਜਰ ਨੂੰ ਸ਼ਿਕਾਇਤ ਕੀਤੀ ਅਤੇ ਦਿਖਾਇਆ ਕਿ ਸਰ ਮੇਰੇ ਖਾਣੇ ਵਿੱਚ ਕੋਕਰੋਚ ਹੈ ਅਤੇ ਉਹਨਾਂ ਨੇ ਕਹਿ ਦਿੱਤਾ ਕਿ ਇਹ ਤਾਂ ਵੈਸੇ ਹੀ ਆ ਗਿਆ ਅਤੇ ਫਿਰ ਮੈਨੂੰ ਬਹੁਤ ਹੀ ਗੁੱਸਾ ਆਇਆ ਅਤੇ ਮੈਂ ਜਾ ਕੇ ਉਹਨਾਂ ਦੀ ਕਿਚਨ ਚੈੱਕ ਕੀਤੀ ਤਾਂ ਉੱਥੇ ਬਹੁਤ ਸਾਰੇ ਹੀ ਕੋਕਰੋਚ ਜੋ ਕਿ ਖਾਣੇ ਉੱਪਰ ਕੁੱਦ ਰਹੇ ਸਨ ਅਤੇ ਉਸ ਤੋਂ ਬਾਅਦ ਮੈਂ ਆਪਣੇ ਘਰ ਆ ਕੇ ਘਰ ਆ ਕੇ ਆਪਣੀ ਰਸੋਈ ਘਰ ਨੂੰ ਸਾਫ ਕੀਤਾ ਅਤੇ ਸਾਨੂੰ ਰਸੋਈ ਘਰ ਨੂੰ ਸਾਫ ਸੁਥਰਾ ਰੱਖਣਾ ਚਾਹੀਦਾ ਹੈ ਸਾਨੂੰ ਕਈ ਵਾਰ ਅਸੀਂ ਰਾਤ ਨੂੰ ਕੀ ਕਰਦੇ ਹਾਂ ਬਰਤਨ ਜੂਠੇ ਛੱਡ ਦਿੰਦੇ ਹਾਂ ਜਾਂ ਸਮਾਨ ਰਸੋਈ ਵਿੱਚ ਇਸ ਤਰ੍ਹਾਂ ਹੀ ਪਿਆ ਰਹਿੰਦਾ ਅਤੇ ਉਸ ਉੱਪਰ ਚੂਹੇ ਕੋਕਰੋਚ ਆ ਕੇ ਕੁੱਦਦੇ ਹਨ ਅਤੇ ਇਹਨਾਂ ਰਾਹੀਂ ਸਾਨੂੰ ਬਹੁਤ ਹੀ ਬਿਮਾਰੀਆਂ ਲੱਗ ਸਕਦੀਆਂ ਹਨ ਸਾਨੂੰ ਇਹਨਾਂ ਤੋਂ ਬਚਾਅ ਕਰਨਾ ਚਾਹੀਦਾ ਹੈ ਸਾਨੂੰ ਆਪਣੇ ਰਸੋਈ ਘਰ ਆਪਣੇ ਆਲੇ ਦੁਆਲੇ ਨੂੰ ਸਾਫ ਰੱਖਣਾ ਚਾਹੀਦਾ ਅਤੇ ਨਦੀ ਨਾਲੀਆਂ ਨੂੰ ਬੰਦ ਕਰਕੇ ਰੱਖਣਾ ਚਾਹੀਦਾ ਹੈ